ਹੈਲੋ ਸਤਿ ਸ਼੍ਰੀ ਅਕਾਲ ਮੈਮ ਕਿੱਦਾਂ ਮੈਮ ਹਾਂਜੀ ਵਧੀਆ ਜੀ ਮੈਮ ਮੈਂ ਮੇਕਅਪ ਬਾਰੇ ਗੱਲ ਕਰਨਾ ਚਾਹੁੰਦੀ ਤੁਹਾਡੇ ਨਾਲ ਮੈਮ ਮੈਂ ਫੰਕਸ਼ਨ 'ਤੇ ਜਾਣਾ ਸੀ ਮੈਮ ਮੈਂ ਪੁੱਛਦੀ ਸੀ ਤੁਹਾਡੇ ਤੋਂ ਵੀ ਮੈਂ ਕਿੱਦਾਂ ਦੀ ਡਰੈੱਸ ਪਹਿਨਾ ਮ ਬਲੀਚ ਕਰਾਂ ਜਾਂ ਫੇਸ਼ੀਅਲ ਵਗੈਰਾ ਕਰਵਾਉਣਾ ਸੀ ਤੁਹਾਡੇ ਤੋਂ ਹਾਂਜੀ ਉਹ ਕਿੱਦਾਂ ਦੀ ਡਰੈੱਸ ਪਹਿਨਾ ਤੁਸੀਂ ਕੁਝ ਸਲਾਹ ਦੇ ਸਕਦੇ ਹੋ ਮੈਨੂੰ ਹਾਂਜੀ ਮੈਮ ਠੀਕ ਹੈ ਮੈਮ ਹਾਂਜੀ ਮੈਮ ਹੇਅਰ ਸਟਾਈਲ ਬਾਰੇ ਪੁੱਛਣਾ ਤਾ ਹਾਂਜੀ ਮਤਲਬ ਕਿ ਤੁਹਾਡੇ ਤੁਸੀਂ ਦ ਦੇਖ ਸਕਦੇ ਹੋ ਤਾਂ ਮੇਰੇ ਕਿਹੜੇ ਹੇਅਰ ਸਟਾਈਲ ਵਧੀਆ ਲੱਗੇਗਾ ਠੀਕ ਹੈ ਮੈਮ ਮੈਮ ਪੈਸੇ ਪ੍ਰਾਈਜ ਕੀ ਆ ਉਹਨਾਂ ਦਾ ਜੀ ਕਿੰਨਾ ਕੁ ਜੀ ਦੱਸੋਗੇ ਨਹੀਂ ਮੈਮ ਵਧੀਆ ਵਧੀਆ ਚਾਹੀਦੀ ਫੋਟੋ ਸ਼ੂਟ 'ਤੇ ਜਾਣਾ ਅਸੀਂ ਹਾਂਜੀ ਮੈਮ ਥੋੜ੍ਹਾ ਲੈਸ ਨਹੀਂ ਹੋ ਸਕਦਾ ਜੀ ਮੈਮ ਅੱਛਾ ਜੀ ਠੀਕ ਹੈ ਮੈਮ ਸੋਚ ਰਹੀ ਸੀ ਕਈ ਦਿਨਾਂ ਤੋਂ ਵੀ ਤੁਹਾਡੇ ਨਾਲ ਗੱਲ ਕਰਾਂ ਪਰ ਮੈਨੂੰ ਟਾਈਮ ਹੀ ਨਹੀਂ ਲੱਗਿਆ ਹਾਂਜੀ ਮੈਮ ਕੋਈ ਨਹੀਂ ਕੋਈ ਨਾ ਮੈਮ

ਠੀਕ ਹੈ ਮੈਮ ਹੋਰ ਕੁਛ ਠੀਕ ਹੈ ਮੈਮ ਠੀਕ ਹੈ ਮੈਮ ਅਤੇ ਮੈਮ ਡਰੈਸ ਪੁੱਛਣੀ ਸੀ ਅਤੇ ਇਸ ਲਈ ਵੀ ਮੈਂ ਸਾੜੀ ਜਾਂ ਕੋਈ ਲਹਿੰਗਾ ਗਾਊਨ ਵਗੈਰਾ ਐਦਾਂ ਦਾ ਠੀਕ ਹੈ ਮੈਮ ਥੈਂਕ ਯੂ ਜੀ ਮੈਮ ਬਾਏ